ਹੈਲੋ ਹੈਲੋ ਜੀ ਤੁਸੀਂ ਗਗਨ ਦੀ ਮੰਮੀ ਗੱਲ ਕਰ ਰਹੇ ਹੋ ਮੈਂ ਉਸ ਦੀ ਅਧਿਆਪਕਾ ਬੋਲ ਰਹੀ ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿ ਤੁਹਾਡਾ ਬੇਟਾ ਗਗਨ ਬਿਮਾਰ ਹੋ ਗਿਆ ਹੈ ਹਾਂ ਸਕੂਲ ਵਿੱਚ ਆਉਂਦੇ ਹੀ ਉਸ ਨੂੰ ਬੁਖਾਰ ਜਿੱਦਾਂ ਦਾ ਲੱਗ ਰਿਹਾ ਹੈ ਅਤੇ ਉਸ ਦੀ ਤਬੀਅਤ ਵੀ ਠੀਕ ਨਹੀਂ ਹੈ ਹਾਂਜੀ ਤੁਸੀਂ ਆ ਕੇ ਉਸ ਨੂੰ ਲੈ ਜਾਵੋ ਅਤੇ ਉਸ ਨੂੰ ਛੁੱਟੀ ਵੀ ਕਰਵਾ ਲਿਓ ਠੀਕ ਹੈ ਜਿੰਨਾ ਟਾਈਮ ਉਹਨਾਂ ਨੂੰ ਆਉਣ ਵਿੱਚ ਲੱਗੇਗਾ ਉਸ ਵੇਲੇ ਤੱਕ ਅਸੀਂ ਉਸ ਨੂੰ ਪ੍ਰਿੰਸੀਪਲ ਦੇ ਆਫਿਸ ਵਿੱਚ ਰੱਖ ਦਿੰਦੇ ਹਾਂ ਆ ਕੇ ਤੁਸੀਂ ਪ੍ਰਿੰਸੀਪਲ ਨਾਲ ਗੱਲ ਕਰ ਲਿਓ ਅਤੇ ਉਸ ਨੂੰ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ